ਸੱਤ ਗਿਆਰ੍ਹਾਂ ਉੱਨੀ ਸੌ ਸੱਤਰ ਦੋ ਪੰਜ ਉੱਨੀ ਸੌ ਤਿਹੱਤਰ ਛੇ ਸੱਤ ਉੱਨੀ ਸੌ ਪਚਾਨਵੇਂ ਦੋ ਚਾਰ ਉੱਨੀ ਸੌ ਇਕਿਆਸੀ ਸੱਤ ਤਿੰਨ ਉੱਨੀ ਸੌ ਪੈਂਹਠ